ਨੱਚਦੇ ਹੋਏ ਮੁੰਡੇ ਪਾਉਂਦੇ ਨੇ ਤੁਰਲੇ ਵਾਲੀ ਪੱਗ ਕੁੜਤਾ ਚਾਦਰਾ ਅਤੇ ਜੋ ਕੁੜੀਆਂ ਹੁੰਦੀਆਂ ਨੇ ਤਾਂ ਉਹ ਸਲਵਾਰ ਸੂਟ ਲਹਿੰਗੇ ਦੇ ਨਾਲ ਵੀ ਉਹ ਪਾਉਂਦੀਆਂ ਨੇ ਅਤੇ ਗਿੱਧਾ ਪਾਉਂਦੀਆਂ ਨੇ ਜੂਲਰੀ ਜਾਨੀ ਕੇ ਉਹਦੇ ਵਿੱਚ ਜੂਲਰੀ ਦੇ ਵਿੱਚ ਉਹ ਸੱਗੀ ਫੁੱਲ ਕੈਂਠਾ ਠੀਕ ਹੈ ਤਾਂ ਤਬੀਤੀਆਂ ਇਹ ਸਭ ਪਾਉਂਦੇ ਨੇ